ਮੇਰੇ ਵਿਚਾਰ ਅਨੁਸਾਰ ਅੱਜ ਕੱਲ੍ਹ ਮੋਬਾਈਲ ਫੀਡ ਜਾਂ ਰੇਡੀਓ ਜਾਂ ਅਖ਼ਬਾਰਾਂ ਕੋਈ ਵੀ ਆ ਜਾਂਦਾ ਮੀਡੀਆ ਦਾ ਸਾਧਨ ਹੈ ਉਹ ਸਹੀ ਖ਼ਬਰਾਂ ਨਹੀਂ ਦਿੰਦਾ ਸੱਚਾਈ ਬਹੁਤ ਹੱਦ ਤੱਕ ਛੁਪਾਈ ਜਾ ਰਹੀ ਹੈ ਜਦੋਂ ਕਿ ਸੱਚਾਈ ਨੂੰ ਬਿਲਕੁਲ ਚੈਨਲ ਜਿਹੜੇ ਨੇ ਆਪਣੀ ਟੀ ਆਰ ਪੀ ਵਧਾਉਣ ਦੇ ਕੇ ਲਈ ਇਹ ਟੀ ਆਰ ਪੀ ਵਧਾਉਣ ਦੇ ਚੱਕਰ ਵਿੱਚ ਕੋਈ ਵੀ ਸਹੀ ਖ਼ਬਰ ਨਹੀਂ ਦਿੰਦੇ ਹਮੇਸ਼ਾ ਉਹ ਖ਼ਬਰ ਨੂੰ ਅਸਲੀ ਨੂੰ ਛੁਪਾਉਂਦੇ ਨੇ ਅਤੇ ਤੋ ਖ਼ਬਰਾਂ ਨੂੰ ਤੋੜ ਮਰੋੜ ਕੇ ਆਪਣੇ ਅਨੁਸਾਰ ਜਾਂ ਕਿਸੇ ਸਪੈਸ਼ਲ ਜਿਹੜੇ ਫੇਵ ਬੰਦਾ ਆ ਉਹਦੇ ਫੇਵਰ ਵਿੱਚ ਕਰਕੇ ਹੀ ਪੇਸ਼ ਕੀਤਾ ਜਾਂਦਾ ਹੈ ਸੱਚਾਈ ਨੂੰ ਕਦੀ ਵੀ ਜਨਤਾ ਦੇ ਸਾਹਮਣੇ ਸਹੀ ਤਰ੍ਹਾਂ ਨਹੀਂ ਫੀਡ ਨਹੀਂ ਪੇਸ਼ ਕੀਤਾ ਜਾਂਦਾ ਮੋਬਾਇਲ ਫੀਡ ਦਾ ਵੀ ਇਹ ਹੀ ਅੱਜ ਕੱਲ੍ਹ ਟਰੈਂਡ ਹੋਇਆ ਪਿਆ ਹੈ ਰੇਡੀਓ ਦਾ ਵੀ ਇਹ ਹੀ ਹੈ ਅਖ਼ਬਾਰਾਂ ਵੀ ਸੇਮ ਹੀ ਕੰਮ ਕਰ ਰਹੀਆਂ ਨੇ ਕੋਈ ਵੀ ਖ਼ਬਰਾਂ ਨੂੰ ਸਹੀ ਜੋ ਐਕਚੁਅਲ ਹਾਲਾਤ ਆ ਉਹਦੇ ਵਿੱਚ ਪੇਸ਼ ਨਹੀਂ ਕਰ ਰਿਹਾ ਜਿਹੜਾ ਕਿ ਅੱਜ ਕੱਲ੍ਹ ਦੇ ਸਮੇਂ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ ਸਾਡੇ ਸਮਾਜ ਦੀ